ਸੈਲਫ ਹੈਲਪ ਗਰੁੱਪ ਅੱਜ ਕੱਲ੍ਹ ਬਹੁਤ ਜ਼ਰੂਰੀ ਹੋ ਗਏ ਨੇ ਔਰਤਾਂ ਲਈ ਰੁਜ਼ ਰੁਜ਼ਗਾਰ ਹੋਣਾ ਇੱਕ ਜ਼ਰੂਰਤ ਬਣ ਚੁੱਕਿਆ ਹੈ ਕਿਸੇ ਦੇ ਉੱਤੇ ਨਿਰਭਰ ਹੋਣਾ ਬਹੁਤ ਮੁਸ਼ਕਿਲ ਹੈ ਹਰ ਪੈਸੇ ਲਈ ਦੂਸਰੇ ਤੋਂ ਮੰਗਾਉਣਾ ਬਹੁਤ ਹੀ ਔਖਾ ਕੰਮ ਲੱਗਦਾ ਹੈ ਇਸ ਲਈ ਅੱਜ ਕੱਲ੍ਹ ਔਰਤਾਂ ਨੂੰ ਰੁਜ਼ਗਾਰ ਲਈ ਕਈ ਕੰਮ ਕਰਨੇ ਮਿਲ ਸਕਦੇ ਹਨ ਉਹ ਲੋਕ ਜਾ ਕੇ ਦੂਜੇ ਬੱਚਿਆਂ ਨੂੰ ਪੜ੍ਹਾ ਸਕਦੀਆਂ ਨੇ ਔਰ ਉੱਥੇ ਉਹਨਾਂ ਨੂੰ ਮੁਆਵਜ਼ਾ ਵੀ ਜ਼ਿਆਦਾ ਮਿਲਦਾ ਹੈ ਕਿਉਂਕਿ ਉਹ ਆਪਣਾ ਘਰ ਛੱਡ ਕੇ ਕਿਸੇ ਦੇ ਘਰ ਜਾ ਕੇ ਉਹਦੇ ਬੱਚੇ ਨੂੰ ਪੜ੍ਹਾ ਰਹੇ ਨੇ ਅਤੇ ਉਹਨਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਉਸ ਤੋਂ ਬਾਅਦ ਤੁਸੀਂ ਟਿਫਨ ਦਾ ਕੰਮ ਵੀ ਕਰ ਸਕਦੇ ਹੋ ਘਰ ਆਪਣੇ ਰੋਟੀ ਬਣਾਓ ਔਰ ਲੋਕਾਂ ਨੂੰ ਸਪਲਾਈ ਕਰੋ ਸਭ ਕੰਮ ਲੋਕ ਕੰਮ ਕਾਰ ਵਾਲੇ ਹੁੰਦੇ ਹਨ ਔਰ ਉਹਨਾਂ ਕੋਲੋਂ ਇਤਨਾ ਟਾਈਮ ਨਹੀਂ ਹੁੰਦਾ ਕਿ ਉਹ ਘਰ ਆਪਣੇ ਖਾਣਾ ਬਣਾ ਸਕਣ ਔਰ ਉਹ ਲੋਕ ਕਦੀ ਨਹੀਂ ਚਾਹੁੰਦੇ ਕਿ ਬਾਜ਼ਾਰੋਂ ਖਾਣਾ ਮੰਗਵਾਇਆ ਜਾਏ ਇਸ ਲਈ ਉਹ ਲੋਕ ਟਿਫਨ ਵੱਲ ਦੌੜਦੇ ਹਨ ਤੁਹਾ ਉਹਨਾਂ ਨੂੰ ਘਰ ਦਾ ਖਾਣਾ ਮਿਲ ਜਾਂਦਾ ਹੈ ਅਤੇ ਤੁਹਾਨੂੰ ਇੱਕ ਰਾਹ ਮਿਲ ਜਾਂਦੀ ਹੈ ਆਪਣਾ ਰੋਜ਼ਗਾਰ ਕਮਾਉਣ ਦਾ ਉਸ ਤੋਂ ਬਾਅਦ ਤੁਸੀਂ ਯੋਗਾ ਵੀ ਸਿਖਾ ਸਕਦੇ ਹੋ ਇਹ ਕਈ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਸਿਖਾਇਆ ਜਾਂਦਾ ਹੈ ਥੋੜ੍ਹੀ ਥੋੜ੍ਹੀ ਫੀਸ ਲੈ ਕੇ ਉਹਨਾਂ ਲੋਕਾਂ ਨੂੰ ਬਹੁਤ ਕੁਛ ਸਿਖਾਇਆ ਜਾਂਦਾ ਹੈ ਉਸ ਤੋਂ ਬਾਅਦ ਕਿੰਨੇ ਇਹੋ ਜਿਹੇ ਕੰਮ ਨੇ ਜਿਹੜੇ ਤੁਸੀਂ ਘਰੋਂ ਬੈਠੇ ਵੀ ਕਰ ਸਕਦੇ ਹੋ